ਮੈਨੂੰ ਫਿਲਮਾਂ ਤੋਂ ਜ਼ਿਆਦਾ ਕਿਤਾਬਾਂ ਪੜ੍ਹਨੀਆਂ ਪਸੰਦ ਹਨ ਮੇਰੀ ਫਿਲਮਾਂ ਵਿੱਚ ਸ਼ੁਰੂ ਤੋਂ ਹੀ ਘੱਟ ਦਿਲਚਸਪੀ ਰਹੀ ਹੈ ਹੌਲੀ ਹੌਲੀ ਕਿਤਾਬਾਂ ਪੜ੍ਹਨ ਦਾ ਸ਼ੌਂਕ ਵੱਧਦਾ ਗਿਆ ਮੇਰੀ ਇੱਕ ਕਿਤਾਬ ਮੇਰੇ ਬਹੁਤ ਦਿਲ ਦੇ ਕਰੀਬ ਹੈ ਜਿਸ ਦਾ ਨਾਂ ਅਪਸਰਾ ਹੈ ਇਹ ਪ੍ਰੀਤ ਕੈਂਥ ਜੀ ਦੀ ਲਿਖੀ ਹੋਈ ਕਿਤਾਬ ਹੈ ਇਸ ਕਿਤਾਬ ਨੂੰ ਮੈਂ ਕਦੇ ਵੀ ਪੜ੍ਹ ਕੇ ਅੱਕੀ ਨਹੀਂ ਮੈਂ ਅੱਜ ਤੱਕ ਇਸ ਕਿਤਾਬ ਨੂੰ ਕਈ ਵਾਰ ਪੜ੍ਹ ਚੁੱਕੀ ਹਾਂ ਇਹ ਕਿਤਾਬ ਇੱਕ ਔਰਤ ਦੀ ਜ਼ਿੰਦਗੀ 'ਤੇ ਹੈ ਉਸ ਔਰਤ ਦੀ ਜ਼ਿੰਦਗੀ ਦਾ ਹਰ ਪਹਿਲੂ ਇਸ ਕਿਤਾਬ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਦਰਸਾਇਆ ਗਿਆ ਹੈ ਕਿ ਕਿੱਦਾਂ ਇੱਕ ਔਰਤ ਆਪਣੇ ਉੱਡਣੇ ਖੰਭ ਫੈਲਾ ਕੇ ਖੁੱਲ੍ਹੇ ਅਸਮਾਨ ਵਿੱਚ ਉਡਾਰੀ ਲਗਾਉਣਾ ਚਾਹੁੰਦੀ ਹੈ ਪਰ ਚੰਦਰੇ ਸਮਾਜ ਕਰਕੇ ਉਹ ਇਹ ਨਹੀਂ ਕਰ ਪਾਉਂਦੀ ਹਰ ਵਾਰ ਉਹਨੂੰ ਹਰ ਔਕੜ ਦਾ ਸਾਹਮਣਾ ਕਰਨਾ ਪੈਂਦਾ ਹੈ ਕੋਈ ਉਸਨੂੰ ਅੱਗੇ ਵੱਧਦੇ ਦੇਖ ਕੇ ਰਾਜ਼ੀ ਨਹੀਂ ਹੁੰਦਾ ਸਗੋਂ ਉਸ ਨੂੰ ਪਿੱਛੇ ਖਿੱਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਸਦੇ ਘਰਦਿਆਂ ਵੱਲੋਂ ਵੀ ਅਤੇ ਉਸ ਦੇ ਰਿਸ਼ਤੇਦਾਰਾਂ ਵੱਲੋਂ ਵੀ ਕੋਈ ਉਸਨੂੰ ਹਿੰਮਤ ਨਹੀਂ ਦਿੰਦਾ ਅਤੇ ਆਖਿਰ ਵਿੱਚ ਉਹ ਹਿੰਮਤ ਹਾਰਨੀ ਸ਼ੁਰੂ ਹੋ ਜਾਂਦੀ ਹੈ ਪਰ ਉਹ ਕੁੜੀ ਬਹੁਤ ਹੀ ਹੌਂਸਲੇ ਵਾਲੀ ਹੁੰਦੀ ਹੈ ਉਹ ਕਿਵੇਂ ਨਾ ਕਿਵੇਂ ਕਰਕੇ ਆਪਣੇ ਖੰਭ ਫਿਰ ਤੋਂ ਖੋਲ੍ਹਣਾ ਸ਼ੁਰੂ ਕਰਦੀ ਹੈ ਇਸ ਕਿਤਾਬ ਤੋਂ ਸਾਨੂੰ ਸਭ ਨੂੰ ਸਿੱਖਿਆ ਮਿਲਦੀ ਹੈ ਕਿ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਹਾਰਨਾ ਨਹੀਂ ਚਾਹੀਦਾ ਸਗੋਂ ਔਕੜਾਂ ਦਾ ਡੱਟ ਕੇ ਸਾਹਮਣਾ ਕਰਨਾ ਚਾਹੀਦਾ ਹੈ